ਜੇਕਰ ਗੱਲ ਕਰੀਏ ਤਾਂ ਮਨਪਸੰਦ ਭੋਜਨ ਤਾਂ ਸਾਡੇ ਬਹੁਤ ਹਨ ਦੇਖਿਆ ਜਾਵੇ ਤਾਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਮੇਰਾ ਸਭ ਤੋਂ ਵਧੀਆ ਲੱਗਣ ਵਾਲਾ ਭੋਜਨ ਹੈ ਇਸ ਨੂੰ ਅਸੀਂ ਘਰ ਵਿੱਚ ਬਹਿ ਕੇ ਖਾਣਾ ਪਸੰਦ ਕਰਦੇ ਹਾਂ ਜੋ ਕਿ ਸਾਰੇ ਪਰਿਵਾਰ ਨਾਲ ਹੱਸ ਮਿਲ ਕੇ ਖਾਂਦੇ ਹਾਂ ਇਹ ਇਸ ਦੇ ਵਿੱਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨ ਵਿੱਚ ਦੇਸੀ ਘੀ ਜਾਂ ਮੱਖਣੀ ਪਾ ਕੇ ਇਸ ਨੂੰ ਖਾਂਦੇ ਹਾਂ ਅਤੇ ਜਿਸ ਨਾਲ ਇਸ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈੈ ਇਸ ਨੂੰ ਜੇਕਰ ਸਾਰੇ ਪਰਿਵਾਰ ਨਾਲ ਬਹਿ ਕੇ ਖਾਇਆ ਜਾਵੇ ਤਾਂ ਇਸ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਪੰਜਾਬ ਦਾ ਵੀ ਬਹੁਤ ਹੀ ਪ੍ਰਸਿੱਧ ਮੰਨਿਆ ਜਾਂਦਾ ਹੈ